ਪਸ਼ੂ ਪਾਲਣ ਦੇ ਵਿੱਚ ਵਿਦੇਸ਼ੀ ਨਸਲਾਂ ਆਪਣੇ ਦੇਸੀ ਨਸਲਾਂ ਨਾਲੋਂ ਜ਼ਿਆਦਾ ਕੀਮਤੀ ਹੁੰਦੀਆਂ ਹਨ ਕੀਮਤੀ ਹੋਣ ਦੇ ਨਾਲ ਨਾਲ ਉਹਨਾਂ ਦਾ ਉਹਨਾਂ ਦਾ ਫਾਇਦਾ ਵੀ ਵੱਧ ਨਿਕਲਦਾ ਹੈ ਜਿਵੇਂ ਕਿ ਦੁੱਧ ਜ਼ਿਆਦਾ ਮਾਸ ਜ਼ਿਆਦਾ ਇਸ ਤਰ੍ਹਾਂ ਮਤਲਬ ਇਹਨਾਂ ਦਾ ਜ਼ਿਆਦਾ ਹੁੰਦਾ ਪਰ ਆਪਣੀ ਜਿਹੜੀਆਂ ਦੇਸੀ ਨਸਲਾਂ ਆ ਇਹਨਾਂ ਦੇ ਵਿੱਚ ਰੋਗ ਨੂੰ ਲੜਨ ਦੀ ਸ਼ਮਤਾ ਜ਼ਿਆਦਾ ਹੁੰਦੀ ਹੈ ਵਿਦੇਸ਼ੀ ਨਸਲਾਂ ਦੇ ਵਿੱਚ ਇਹ ਸ਼ਮਤਾ ਥੋੜ੍ਹੀ ਸਾਡੇ ਭਾਰਤ ਦੇ ਵਾਤਾਵਰਨ ਦੇ ਅਨੁਕੂਲ ਘੱਟ ਹੁੰਦੀ ਹੈ ਇਹਨਾਂ ਦੇ ਉੱਤੇ ਖਰਚਾ ਵੀ ਜ਼ਿਆਦਾ ਆਉਂਦਾ ਵਿਦੇਸ਼ੀ ਨਸਲਾਂ ਦੇ ਉੱਤੇ ਅਤੇ ਆਪਣੀਆਂ ਨਸਲਾਂ ਦੇ ਉੱਤੇ ਇਹ ਖਰਚਾ ਬਹੁਤ ਘੱਟ ਜਾਂਦਾ ਧੰਨਵਾਦ